ਹੈਲੋ ਹਾਂਜੀ ਸਰ ਤੁਸੀਂ ਊਜ਼ਿਕ ਅਕੈਡਮੀ ਤੋਂ ਬੋਲਦੇ ਸਰ ਮੈਂ ਆਪਣੇ ਬੱਚੇ ਨੂੰ ਐਡਮੀਸ਼ਨ ਕਰਵਾਉਣੀ ਮਿਊਜ਼ਿਕ ਕੈ ਅਕੈਡਮੀ ਵਿੱਚ ਮੈਨੂੰ ਰੀਝ ਹੈ ਕਿ ਮੇਰਾ ਬੱਚਾ ਮਿਊਜ਼ਿਕ ਅਕੈਡਮੀ ਦੇ ਵਿੱਚ ਵੇ ਸਿੱਖਿਆ ਲਵੇ ਤੁਸੀਂ ਸਾਨੂੰ ਕੋਈ ਜਾਣਕਾਰੀ ਦੇ ਸਕਦੇ ਹੋ ਕੋਈ ਪ੍ਰਸਿੱਧ ਕਲਾਕਾਰ ਹਾਂਜੀ ਸਰ ਹਾਂਜੀ ਓਕੇ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਉੱਥੇ ਹੀ ਓਕੇ ਸਰ